ਨਵੇਂ ਬੱ ਜਨਮੇ ਬੱਚੇ ਨੂੰ ਸਵੱਛ ਭਾਰਤ ਵਾਤਾਵਰਨ ਵਿੱਚ ਰੱਖਣ ਲਈ ਬਹੁਤ ਸਾਰੇ ਉਪਾਅ ਦਿੱਤੇ ਜਾਂਦੇ ਹਨ ਜਿਵੇਂ ਕਿ ਸਫਾਈ ਅਤੇ ਸੈਨੀਟੇਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੱਥਾਂ ਨੂੰ ਸਾਫ ਰੱਖੋ ਅਤੇ ਬੱਚੇ ਨੂੰ ਛੂਹਣ ਤੋਂ ਪਹਿਲਾਂ ਹੱਥ ਧੋਵੋ ਬੱਚੇ ਦੇ ਖੇਡਣ ਵਾਲੇ ਖਿਡੌਣੇ ਅਤੇ ਸਮਾਨ ਨੂੰ ਨਿਰੰਤਰ ਸਾਫ ਕਰਦੇ ਰਹੋ ਸੈਨੇਟਾਈਜ਼ਰ ਕਰਦੇ ਰਹੋ ਬੱਚੇ ਦੀ ਸਵੱਛਤਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਬੱਚੇ ਦੀ ਨਾਲੀ ਅਤੇ ਜਨਮ ਸਥਾਨ ਦੀ ਸਫਾਈ ਸਹੀ ਢੰਗ ਨਾਲ ਅਗਰ ਕੀਤੀ ਜਾਵੇ ਤਾਂ ਬੱਚੇ ਦੀ ਸਿਹਤ ਉੱਤੇ ਇੱਕ ਚੰਗਾ ਅਸਰ ਪਵੇਗਾ ਇਸ ਤੋਂ ਇਲਾਵਾ ਬੱਚੇ ਦੇ ਕੱਪੜੇ ਤੌਲੀਏ ਬੈਡਸ਼ੀਟ ਆਦਿ ਨੂੰ ਚੰਗੇ ਗਰਮ ਪਾਣੀ ਜਾਂ ਕਿਸੇ ਡਟੋਲ ਵਗੈਰਾ ਕੀਟਾਣੂ ਨਾਸ਼ਕ ਲਿਕੁਅਡ ਦੇ ਮਦਦ ਨਾਲ ਹੀ ਧੋਵੋ ਜਿਹਦੇ ਨਾਲ ਕੀਟਾਣੂ ਬੱਚੇ ਦੇ ਕੱਪੜਿਆਂ ਦੇ ਰਾਹੀਂ ਹੁੰਦੇ ਹੋਏ ਉਸਦੇ ਬਾਡੀ ਦੇ ਨਾਲ ਨਾ ਟੱਚ ਹੋਣ ਬੱਚੇ ਦੇ ਆਸ ਪਾਸ ਦਾ ਵਾਤਾਵਰਨ ਜਿਵੇਂ ਕੀ ਕਮਰੇ ਨੂੰ ਸਾਫ ਰੱਖਣਾ ਸੁਰੱਖਿਅਤ ਤਰੀਕੇ ਨਾਲ ਸਾਫ ਕੀਤੀ ਜਾ ਸਕਦੀ ਹੈ ਘਰ ਵਿੱਚ ਧੂੜ ਅਤੇ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵੀ ਹਨ ਇਸ ਤੋਂ ਇਲਾਵਾ ਦੁੱਧ ਪਿਲਾਉਣ ਅਤੇ ਖਾਣਾ ਖਵਾਉਣ ਵੇਲੇ ਵੀ ਬੱਚੇ ਨੂੰ ਇੱਕ ਚੰਗੇ ਵਾਤਾਵਰਨ ਦਾ ਹੋਣਾ ਜ਼ਰੂਰੀ ਹੈ ਬੱਚੇ ਨੂੰ ਕੁਛ ਖਵਾਉਣ ਤੋਂ ਪਹਿਲਾਂ ਉਸ ਦੇ ਭਾਂਡੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਧੋਤਾ ਜਾਵੇ ਤਾਂ ਜੋ ਕੋਈ ਵੀ ਗੰਦੇ ਬੈਕਟੀਰੀਆ ਉਸਦੇ ਰਾਹੀਂ ਨਾ ਹੁੰਦੇ ਹੋਏ ਉਸਦੇ ਪੇਟ ਵਿੱਚ ਚਲੇ ਜਾਣ ਜਿਸਦੇ ਨਾਲ ਬੱਚੇ ਦਾ ਇਮਊਨਿਟੀ ਸਿਸਟਮ ਘੱਟ ਜਾਂਦਾ ਹੈ ਦੁੱਧ ਦੀਆਂ ਬੋਤਲਾਂ ਅਤੇ ਚੂਸਣੀ ਨੂੰ ਵੀ ਸੈਨੇਟਾਈਜ ਕਰੋ ਧੰਨਵਾਦ